ਹੈਲੋ ਤੁਸੀਂ ਜਸ਼ਨ ਪੇਂਟਰ ਤੋਂ ਬੋਲਦੇ ਹੋ ਮੈਨੂੰ ਤੁਹਾਡਾ ਨੰਬਰ ਮੇਰੀ ਫਰੈਂਡ ਨੇ ਦਿੱਤਾ ਸੀਗਾ ਅਸੀਂ ਘਰ ਬਣਵਾਇਆ ਸੀਗਾ ਹੁਣ ਉਹ ਕੰਪਲੀਟ ਹੋ ਗਿਆ ਤਾਂ ਅਸੀਂ ਪੇਂਟ ਕਰਵਾਉਣਾ ਸੀ ਹਾਂਜੀ ਹਾਂਜੀ ਅਸੀਂ ਨਾ ਅਸੀਂ ਮਤਲਬ ਅਸੀਂ ਰੂਮ 'ਚ ਏ ਸੀ ਲਗਵਾਵਾਂਗੇ ਮਤਲਬ ਪੇਂਟ ਕਰਵਾਉਣਾ ਡੈਕੋਰੇਟ ਹੈਲੋ ਹਾਂਜੀ ਹਾਂਜੀ ਹਾਂਜੀ ਤੁਹਾਨੂੰ ਤੁਸੀਂ ਪੇਂਟਰ ਹੋ ਤੁਹਾਨੂੰ ਪਤਾ ਹੈ ਵੀ ਕਿਵੇਂ ਅੱਜ ਕੱਲ੍ਹ ਸੋਹਣਾ ਲੱਗਦਾ ਹੈਗਾ ਸੋ ਤੁਸੀਂ ਆਪਦੇ ਅਕੋਰਡਿੰਗ ਕਰ ਸਕਦੇ ਹੋ ਹਾਂਜੀ ਪੀ ਵੀ ਸੀ ਸ਼ੀਟਸ ਵੀ ਅੱਜ ਕੱਲ੍ਹ ਸੋਹਣੀਆਂ ਲੱਗਦੀਆਂ ਨਾ ਹਾਂਜੀ ਹਾਂਜੀ ਸਾਡਾ ਬਜਟ ਵੀ ਹੈਗਾ ਅਸੀਂ ਉਹਦੇ ਵਿੱਚ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਾਡੇ ਬਜਟ 'ਚ ਹੈ ਹਾਂਜੀ ਹਾਂਜੀ ਹਾਂਜੀ ਹੈਗਾ

ਹਾਂਜੀ ਹਾਂਜੀ ਮੈਂ ਹੁਣੇ ਆਪਦੀ ਫੈਮਲੀ ਨਾਲ ਡਿਸਕਸ ਕਰਕੇ ਤੁਹਾਨੂੰ ਦੱਸਦੀ ਹਾਂ ਹਾਂਜੀ ਹਾਂਜੀ ਮੈਂ ਡਿਸ ਹਾਂਜੀ ਹਾਂਜੀ ਠੀਕ ਹੈ ਮੈਂ ਡਿਸਕਸ ਕਰਦੀ ਹਾਂ ਆਪਣੀ ਫੈਮਿਲੀ ਨਾਲ ਅਤੇ ਫਿਰ ਤੁਹਾਨੂੰ ਦੱਸਦੀ ਹਾਂ ਹਾਂਜੀ ਠੀਕ ਬਾਏ